ਕਈ ਸਾਲਾਂ ਤੋਂ ਫੋਟੋਗਰਾਫੀ ਅਤੇ ਨਵੀਂ ਫੋਟੋਗਰਾਫੀ ਵਿੱਚ ਕੀ ਕੀ ਬਦਲਾਅ ਆਇਆ ਹੈ ਫੋਟੋਗਰਾਫੀ ਨਵੀਂ ਫੋਟੋਗਰਾਫੀ ਅਤੇ ਪੁਰਾਣੀ ਫੋਟੋਗਰਾਫੀ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਚੁੱਕਿਆ ਹੈ ਪੁਰਾਣੇ ਸਮਿਆਂ ਵਿੱਚ ਬਲੈਕ ਐਂਡ ਵਾਈਟ ਫੋਟੋਆਂ ਖਿੱਚੀਆਂ ਜਾਂਦੀਆਂ ਖਿੱਚੀਆਂ ਜਾਂਦੀਆਂ ਸਨ ਅਤੇ ਉਸੇ ਤਰ੍ਹਾਂ ਦੀ ਵੀਡੀਓਗ੍ਰਾਫੀ ਕੀਤੀ ਜਾਂਦੀ ਸੀਗੀ ਅਤੇ ਅੱਜ ਕੱਲ੍ਹ ਜਿਵੇਂ ਨਵੀਂ ਟੈਕਨੋਲੋਜੀ ਆ ਗਈ ਨਵੇਂ ਮੋਬਾਈਲ ਫੋਨ ਆ ਗਏ ਜਿਵੇਂ ਜਿਵੇਂ ਸਾਇੰਸ ਤਰੱਕੀ ਕਰ ਰਿਹਾ ਹੈ ਉਵੇਂ ਉਵੇਂ ਉਵੇਂ ਉਵੇਂ ਫੋਟੋਗ੍ਰਾਫੀ ਵੀ ਚੇਂਜ ਹੁੰਦੀ ਜਾ ਰਹੀ ਹੈ ਲੋਕਾਂ ਕੋਲ ਨਵੇਂ ਤੋਂ ਨਵੇਂ ਫੋਨ ਆ ਗਏ ਹਨ ਜਿਹਨਾਂ ਨਾਲ ਕੈਮਰਿਆਂ ਵਿੱਚ ਵੀ ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਹੈ ਪਹਿਲਾਂ ਦੇ ਸਮਿਆਂ ਵਿੱਚ ਲੋਕ ਹੱਸਦੇ ਰਹਿੰਦੇ ਸੀਗੇ ਉਸੇ ਤ ਪ੍ਰਕਾਰ ਦੀਆਂ ਉਹਨਾਂ ਦੀਆਂ ਫੋਟੋਆਂ ਹੁੰਦੀਆਂ ਸਨ ਬਲੈਕ ਐਂਡ ਵਾਈਟ ਫੋਟੋਆਂ ਹੁੰਦੀਆਂ ਸਨ ਨਾ ਜ਼ਿਆਦਾ ਉਸ ਟਾਈਮ 'ਤੇ ਸਾਇੰਸ ਨੇ ਤਰੱਕੀ ਕੀਤੀ ਸੀਗੀ ਅਤੇ ਨਾ ਹੀ ਉਦੋਂ ਮੋਬਾਇਲ ਫੋਨ ਅਤੇ ਕੈਮਰਿਆ ਵਾਲੇ ਫੋਨ ਸਨ ਅਤੇ ਨਾ ਹੀ ਕੈਮਰੇ ਸਨ ਉਦੋਂ ਬਸ ਫੋਟੋਗਰਾਫਰਾਂ ਕੋਲ ਕੈਮਰੇ ਹੁੰਦੇ ਸਨ ਜਿਹਨਾਂ ਨਾਲ ਉਹ ਫੋਟੋਗਰਾਫੀ ਕੀਤੀ ਜਾਂਦੀ ਸੀ ਜੋ ਕਿ ਬਲੈਕ ਐਂਡ ਵਾਈਟ ਹੁੰਦੀ ਸੀਗੀ ਅੱਜ ਕੱਲ੍ਹ ਦੇ ਸਮੇਂ ਵਿੱਚ ਹਰ ਇੱਕ ਕੋਲ ਮੋਬਾਈਲ ਫੋਨ ਹੈ ਅਤੇ ਕੈਮਰੇ ਉਂ ਕੈਮਰੇ ਹਨ ਜੋ ਕਿ ਫੋਟੋਗ੍ਰਾਫਰ ਤੋਂ ਫੋਟੋਆਂ ਖਿਚਾਉਣ ਦੀ ਬਜਾਏ ਆਪਣੇ ਵਿੱਚ ਆਪਣੇ ਕੋਲ ਹੀ ਫੋਟੋਆਂ ਸੇਵ ਕਰਕੇ ਰੱਖਦੇ ਹਨ ਅਤੇ ਸੈਲਫੀਆਂ ਲੈਂਦੇ ਹਨ ਜੋ ਕਿ ਉਸ ਸਮੇਂ ਤੋਂ ਬਹੁਤ ਜ਼ਿਆਦਾ ਵੱਖਰੀਆਂ ਹੁੰਦੀਆਂ ਹਨ